ਔਨਲਾਈਨ ਸਟੱਡੀ ਦਾ ਸਭ ਤੋਂ ਵੱਧ ਫਾਇਦਾ ਤਾਂ ਕੋਵਿਡ ਦੇ ਟਾਈਮ ਹੋਇਆ ਜਦੋਂ ਕਿ ਲੋਕਡਾਊਨ ਹੋ ਗਿਆ ਸੀ ਅਤੇ ਬੱਚੇ ਆਪਣੇ ਘਰਾਂ ਦੇ ਵਿੱਚ ਬੰਦ ਸਨ ਉਸ ਟਾਈਮ ਦੇ ਉੱਤੇ ਔਨਲਾਈਨ ਸਟੱਡੀ ਨੇ ਬਹੁਤ ਹੀ ਸ ਫਾਇਦਾ ਦਿੱਤਾ ਐੱਨ ਪੀ ਟੀ ਐੱਲ ਅਤੇ ਸਵਯਮ ਐਸੇ ਕੋਰਸ ਹਨ ਜਿਹੜੇ ਔਨਲਾਈਨ ਅਵੇਲੇਬਲ ਹਨ ਐੱਨ ਪੀ ਟੀ ਐੱਲ ਅਤੇ ਸਵਯਮ ਦੇ ਉੱਤੇ ਆਈ ਆਈ ਟੀ ਦੇ ਪ੍ਰੋਫੈਸਰਾਂ ਵੱਲੋਂ ਵੀਡੀਓ ਲੈਕਚਰਸ ਬਣਾਏ ਗਏ ਹਨ ਅਲੱਗ ਅਲੱਗ ਸਬਜੈਕਟਸ ਦੇ ਉੱਤੇ ਬੱਚੇ ਕੋਈ ਵੀ ਕੋਰਸ ਚੂਜ ਕਰ ਸਕਦੇ ਹਨ ਅਤੇ ਉਸ ਆਈ ਆਈ ਟੀ ਦੇ ਪ੍ਰੋਫੈਸਰ ਦੀ ਵੀਡੀਓ ਲੈਕਚਰ ਸੁਣ ਸਕਦੇ ਹਨ ਅਗਰ ਬੱਚੇ ਚਾਹੁੰਣ ਤਾਂ ਐਨਰੋਲ ਕਰਕੇ ਉਹ ਉਸਦਾ ਐਗਜ਼ਾਮ ਵੀ ਕਲੀਅਰ ਕਰ ਸਕਦੇ ਹਨ ਇਹ ਜਿਹੜੇ ਕੋਰਸ ਹੁੰਦੇ ਹਨ ਅੱਠ ਹਫਤੇ ਛੇ ਹਫਤੇ ਜਾਂ ਬਾਰਾਂ ਹਫਤਿਆਂ ਇਸ ਤਰ੍ਹਾਂ ਅਲੱਗ ਅਲੱਗ ਡੋਰੇਸ਼ਨ ਦੇ ਹੁੰਦੇ ਹਨ ਹਰ ਹਫਤੇ ਇੱਕ ਅਸਾਈਨਮੈਂਟ ਆਉਂਦੀ ਹੈ ਇੱਕ ਹਫਤੇ ਪਹਿਲਾਂ ਲੈਕਚਰ ਚਲਦੇ ਹਨ ਫਿਰ ਉਸ ਲੈਕਚਰਾਂ ਦੇ ਬੇਸਿਸ ਦੇ ਉੱਤੇ ਅਸਾਈਨਮੈਂਟ ਆਉਂਦੀ ਹੈ ਇਹ ਇੱਕ ਬਹੁਤ ਹੀ ਵਧੀਆ ਪਲੈਟਫੋਮ ਹੈ ਬੱਚਿਆਂ ਦੀ ਨੌਲੇਜ ਐਨਹਾਂਸ ਕਰਨ ਲਈ ਹਾਂ ਮੈਂ ਇਹ ਇਹ ਮੈਨਸ਼ਨ ਕਰਨਾ ਚਾਹਵਾਂਗੀ ਕਿ ਜਿੱਥੇ ਔਨਲਾਈਨ ਐਜੂਕੇਸ਼ਨ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲ ਰਹੀ ਹੈ ਪਰ ਫਿਜੀਕਲ ਐਜੂਕੇਸ਼ਨ ਮਤਲਬ ਜਦੋਂ ਆਪਾਂ ਫੇਸ ਟੂ ਫੇਸ ਪੜ੍ਹਦੇ ਹਾਂ ਤਾਂ ਉਸਦਾ ਇੱਕ ਅਲੱਗ ਪ੍ਰਭਾਵ ਹੁੰਦਾ ਹੈ ਬੱਚੇ ਨੂੰ ਕਲਾਸ ਦੇ ਵਿੱਚ ਬੈਠਣਾ ਸੋਸ਼ਲ ਹੋਣਾ ਬਹੁਤ ਸਾਰੀਆਂ ਚੀਜ਼ਾਂ ਬਾਰੇ ਪਤਾ ਲੱਗਦਾ ਹੈ ਬੱਚੇ ਨੂੰ ਪਤਾ ਲੱਗਦਾ ਹੈ ਕਿ ਆਪਣੇ ਪੀਅਰ ਸ ਦੇ ਨਾਲ ਪੀਅਰਸ ਦੇ ਨਾਲ ਮਤਲਬ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਕਿੱਦਾਂ ਕੰਪੀਟ ਕਰਨਾ ਹੈ ਕਿੱਦਾਂ ਉਹਨਾਂ ਤੋਂ ਸਿੱਖਣਾ ਹੈ ਕਿੱਦਾਂ ਉਹਨਾਂ ਦੇ ਨਾਲ ਕੋਮਨੀਕੇਟ ਕਰਨਾ ਔਨਲਾਈਨ ਦੇ ਵਿੱਚ ਬੱਚਾ ਸੋਸ਼ਲ ਨਹੀਂ ਹੁੰਦਾ ਅਤੇ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਹੈਜੀਟੇਟ ਕਰ ਦਿੰਦਾ ਹੈ ਪਰ ਜਿਵੇਂ ਕਿ ਕੋਵਿਡ ਦੇ ਦੌਰਾਨ ਲੋਕਡਾਊਨ ਸੀ ਅਤੇ ਬੱਚੇ ਸਕੂਲ ਜਾਂ ਕੋਲਜ ਨਹੀਂ ਜਾ ਰਹੇ ਸੀ ਉਸ ਟਾਈਮ 'ਤੇ ਔਨਲਾਈਨ ਸਟੱਡੀ ਨੇ ਬੱਚਿਆਂ ਦਾ ਬਹੁਤ ਹੀ ਸਾਥ ਦਿੱਤਾ ਅਤੇ ਬੱਚਿਆਂ ਦੀ ਨੌਲੇਜ ਐਨਹਾਸ ਕੀਤੀ